ਦਿਹਾਤੀ ਖੇਤਰਾਂ ਦੇ ਵਿੱਚ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਨੇ ਅਨਪੜ੍ਹ ਹੁੰਦੇ ਨੇ ਉਹਨਾਂ ਨੂੰ ਸਿੱਖਿਆ ਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਜਿਸ ਦੇ ਕਾਰਨ ਉਹ ਟੈਕਨੋਲੋਜੀ ਦਾ ਸਹੀ ਤਰੀਕੇ ਨਾਲ ਸਹੀ ਢੰਗ ਦੇ ਨਾਲ ਇਸਤੇਮਾਲ ਕਰਨਾ ਨਹੀਂ ਜਾਣਦੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈਂਦਾ ਆ ਉਹ ਏ ਇਹ ਨਹੀਂ ਚਾਹੁੰਦੇ ਕਿ ਟੈਕਨੋਲੋਜੀ ਦਾ ਉਹ ਕਿਵੇਂ ਲਾਭ ਉਠਾ ਸਕਦੇ ਨੇ ਇਸਦਾ ਕਾਰਨ ਇਹ ਹੀ ਹੁੰਦਾ ਆ ਕਿ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਉਹ ਘੱਟ ਪੜ੍ਹੇ ਲਿਖੇ ਹੁੰਦੇ ਨੇ ਮੁੱਢਲੀ ਸਿੱਖਿਆ ਜਿਹੜੀ ਉਹਨਾਂ ਨੇ ਪ੍ਰਾਪਤ ਨਹੀਂ ਕੀਤੀ ਹੁੰਦੀ ਇੰਨੇ ਯੋਗ ਨਹੀਂ ਹੁੰਦੇ ਕਿ ਉਹ ਟੈਕਨੋਲੋਜੀ ਦੇ ਅਰਥਾਂ ਨੂੰ ਅਤੇ ਉਸਦੇ ਇਸਤੇਮਾਲ ਨੂੰ ਉਸਦੇ ਉਸਦੇ ਲਾਭਦਾਇਕ ਇਸਤੇਮਾਲ ਨੂੰ ਜਿਹੜਾ ਹੈ ਉਹ ਸਮਝ ਸਕਣ ਸੋ ਇਹ ਹੀ ਕਾਰਨ ਆ ਕਿ ਉਹਨਾਂ ਨੂੰ ਜਿਹੜੀ ਆ ਸਮੱਸਿਆ ਆਉਂਦੀ ਆ ਤਕਨਾਲੋਜੀ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨ ਦੇ ਵਿੱਚ ਔਰ ਇਸ ਦਾ ਮੁੱਖ ਕਾਰਨ ਉਹਨਾਂ ਦੀ ਅਨਪੜ੍ਹਤਾ ਅਤੇ ਘੱਟ ਸਿੱਖਿਅਕ ਹੋਣਾ ਹੀ ਹੁੰਦਾ ਆ